ਵਿਆਹ ਵਰਗੇ ਵੱਡੇ ਸਮਾਰੋਹ ਵਿੱਚ ਪਾਣੀ ਦੀ ਬੜੀ ਲੋੜ ਹੁੰਦੀ ਹੈ ਖ਼ਾਸ ਕਰਕੇ ਗਰਮੀ ਵਿੱਚ ਹਰ ਥੋੜ੍ਹੇ ਥੋੜ੍ਹੇ ਦੇਰ ਬਾਅਦ ਪਾਣੀ ਪੀਣ ਦਾ ਜੀਅ ਕਰਦਾ ਇਸ ਲਈ ਪਹਿਲਾਂ ਤਾਂ ਅਸੀਂ ਘਰ ਦੇ ਹੀ ਭਾਂਡੇ ਜਿਵੇਂ ਕਿ ਜੱਗ ਬੋਤਲਾਂ ਭਰ ਕੇ ਰੱਖਦੇ ਹਾਂ ਅਤੇ ਬਿਸਲੇਰੀ ਦੀਆਂ ਪਾਣੀ ਦੀਆਂ ਛੋਟੀਆਂ ਛੋਟੀਆਂ ਬੋਤਲਾਂ ਪਹਿਲਾਂ ਤੋਂ ਹੀ ਮੰਗਵਾ ਕੇ ਰੱਖਦੇ ਹਾਂ ਫਿਰ ਆਏ ਗਏ ਲਈ ਨਹਾਉਣ ਧੋਣ ਦਾ ਵੀ ਇੰਤਜ਼ਾਮ ਕਰਨਾ ਪੈਂਦਾ ਉਹਦੇ ਲਈ ਹਰ ਘਰ 'ਚ ਹਜ਼ਾਰ ਹਜ਼ਾਰ ਲੀਟਰ ਦੀ ਤਕਰੀਬਨ ਦੋ ਟੈਂਕੀਆਂ ਲੱਗੀਆਂ ਹੁੰਦੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਤਾਜ਼ਾ ਪਾਣੀ ਆਵੇ ਤਾਂ ਮੋਟਰ ਲਗਾ ਕੇ ਪਹਿਲਾਂ ਟੈਂਕੀ ਪੂਰੀ ਕਰ ਲਈਏ ਤਾਂ ਜੋ ਫਿਰ ਦਿੱਕਤ ਨਾ ਹੋਵੇ ਭਾਂਡੇ ਵੀ ਅਸੀਂ ਟੈਂਕੀ ਦੇ ਪਾਣੀ ਨਾਲ ਹੀ ਧੋ ਲੈਂਦੇ ਹਾਂ ਅਤੇ ਜੇ ਆਏ ਗਏ ਲਈ ਥੋੜ੍ਹਾ ਪਾਣੀ ਘੱਟ ਹੋ ਜਾਵੇ ਤਾਂ ਉਸ ਵੇਲੇ ਆਪਾਂ ਬਾਹਰੋਂ ਬੋਤਲਾਂ ਮੰਗਵਾ ਲੈਂਦੇ ਹਾਂ ਅਤੇ ਇਸ ਤਰ੍ਹਾਂ ਸਾਰਾ ਪ੍ਰਬੰਧ ਪਾਣੀ ਦਾ ਹੋ ਹੀ ਜਾਂਦਾ ਹੈ ਵਿਆਹ ਵਰਗੇ ਵੱਡੇ ਸਮਾਰੋਹ ਵਿੱਚ